ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਠੀਕ ਠਾਕ ਆ ਮੈਮ ਓ ਮੈਮ ਥੋੜ੍ਹਾ ਜਿਹਾ ਸਿਹਤ ਨਹੀਂ ਠੀਕ ਸੀਗੀ ਇਸ ਕਰਕੇ ਮੈਂ ਅੱਜ ਲੀਵ ਲਈ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਉਹਦੇ ਬਾਰੇ ਕੀ ਸਪੀਚ ਤਿਆਰ ਕਰਨੀ ਜਾਂ ਕਿੱਦਾਂ ਤੁਸੀਂ ਕੀ ਚਾਹੁੰਦੇ ਅੱਛਾ ਅੱਛਾ ਠੀਕ ਆ ਮੈਮ ਹਾਜੀ ਠੀਕ ਹੈ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਮੈਂ ਕਰ ਸਕਦੀ ਹਾਂ ਜਿਦਾਂ ਭਗਤ ਸਿੰਘ ਲਾਈਫ ਹਿਸ ਜ ਜੋ ਵੀ ਇਤਿਹਾਸ ਆ ਉਹਨਾਂ ਦਾ ਭਗਤ ਸਿੰਘ ਦਾ ਜੋ ਵੀ ਮਤਲਬ ਆਪਣੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਉਹਦੇ ਬਾਰੇ ਜਾਂ ਸੁਭਾਸ਼ ਚੰਦਰ ਬੋਸ ਜਾਂ ਆਪਣੇ ਲਾਲਾ ਲਾਜਪਤ ਰਾਏ ਜੀ ਆ ਮਹਾਤਮਾ ਗਾਂਧੀ ਜੀ ਆ ਇਹਨਾਂ ਦੇ ਬਾਰੇ 'ਚ ਮੈਂ ਲਿਖ ਲਉਗੀ ਜਿੰਨੀ ਕੁ ਮੈਨੂੰ ਹੈਗੀ ਆ ਜਾਂ ਜਿੱਦਾਂ ਕਿ ਮੈਨੂੰ ਜਾਣਕਾਰੀ ਹੈਗੀ ਆ ਮੈਂ ਲਿਖ ਲਊਂਗੀ ਫਿਰ ਮੈਂ ਤੁਹਾਨੂੰ ਚੈੱਕ ਕਰਵਾ ਲਊਂਗੀ ਤੁਸੀਂ ਮੈਨੂੰ ਹੋਰ ਜੇ ਹੋਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਮੈਮ ਨਹੀਂ ਮੈਮ ਮਤਲਬ ਜਿੱਦਾਂ ਅਸੀਂ ਇਹ ਕਰਾਂਗੇ ਨਾ ਕਿ ਹਰੇਕ ਫਰੀਡਮ ਫਾਈਟਰ ਆਪਾਂ ਦੱਸ ਕੇ ਮੇਨ ਇਹ ਇਹ ਵਾਲੇ ਫਰੀਡਮ ਫਾਈਟਰ ਸੀਗੇ ਉਹਨਾਂ ਦਾ ਥੋੜ੍ਹਾ ਥੋੜ੍ਹਾ ਮਤਲਬ ਜੋ ਇਹਨਾਂ ਦਾ ਯੋਗਦਾਨ ਸੀ ਉਹ ਆਪਾਂ ਮਤਲਬ ਲਿਖ ਲਵਾਂਗੇ ਹੈ ਨਾ ਉਹਦੇ ਬਾਰੇ ਥੋੜ੍ਹਾ ਥੋੜ੍ਹਾ ਹਾਲੇ ਤਕ ਹਾਂਜੀ ਅੱਛਾ ਠੀਕ ਆ ਹਾਂਜੀ ਜਿਦਾਂ ਮੈਮ ਭਗਤ ਸਿੰਘ ਹਾਂਜੀ ਸ਼ਹੀਦ ਭਗਤ ਸਿੰਘ ਦਾ ਜਿੱਦਾਂ ਸੀਗਾ ਕਿ ਉਹਨਾਂ ਨੇ ਉਹਨਾਂ ਦਾ ਕਿਉਂਕਿ ਬਚਪਨ ਹੀ ਬਹੁਤ ਜ਼ਿਆਦਾ ਦਿਲਚਸਪੀ ਲੈਂਦੇ ਸੀ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਜੋ ਜਦੋਂ ਛੋਟੇ ਹੁੰਦੇ ਸੀ ਉਹਨਾਂ ਦੇ ਕਹਾਣੀਆਂ ਜੁੜੀਆਂ ਹੋਈਆਂ ਹੈ ਕਿ ਬਈ ਉਹ ਬਚਪਨ ਵਿੱਚ ਖੇਤਾਂ ਵਿੱਚ ਗਏ ਸੀ ਅਤੇ ਉੱਥੇ ਉਹ ਬੰਦੂਕਾਂ ਕਹਿੰਦੇ ਸੀਗੇ ਕਿ ਮੈਂ ਬੰਦੂਕਾਂ ਬੀਜਣ ਲੱਗਾ ਹਾਂ ਉਹ ਵਾਲੀ ਹਾਂਜੀ ਹਾਂਜੀ ਹਾਂਜੀ ਠੀਕ ਆ ਮੈਮ ਹਾਂਜੀ ਹਾਂਜੀ ਠੀਕ ਹੈ ਓ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਠੀਕ ਹੈ ਓਕੇ ਮੈਮ ਥੈਂਕ ਯੂ